ਹਾਂ ਮੇਰਾ ਮਨਪਸੰਦ ਲੇਖਕ ਹੈ ਪੰਜਾਬੀ ਦੇ ਪ੍ਰਸਿੱਧ ਕਵੀ ਅਤੇ ਲੇਖਕ ਸੁਰਜੀਤ ਪਾਤਰ ਉਹਨਾਂ ਦਾ ਜਨਮ ਉੱਨੀ ਸੌ ਪੰਤਾਲੀ ਵਿੱਚ ਹੋਇਆ ਸੀ ਅਤੇ ਉਹਨਾਂ ਦੀ ਹੁਣ ਮੌਤ ਗਿਆਰ੍ਹਾਂ ਮਈ ਦੋ ਹਜ਼ਾਰ ਚੌਵੀ ਨੂੰ ਹੋਈ ਹੈ ਉਹਨਾਂ ਦੀਆਂ ਲਿਖਤਾਂ ਦੇ ਵਿੱਚ ਪੰਜਾਬ ਦੇ ਪਾਸਟ ਦੀਆਂ ਘਟਨਾਵਾਂ ਨਕਸਲਵਾਦ ਅਤੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਬਹੁਤ ਹੀ ਸੁੰਦਰ ਸ਼ਬਦਾਂ ਵਿੱਚ ਬਿਆਨ ਕੀਤਾ ਗਿਆ ਹੈ ਉਹਨਾਂ ਦੀਆਂ ਪ੍ਰਸਿੱਧ ਰਚਨਾਵਾਂ ਜੋ ਕਿ ਮੈਨੂੰ ਬਹੁਤ ਪਸੰਦ ਹਨ ਬਿਰਖ ਅਰਜ ਕਰ ਅਰਜ ਕਰੇ ਇਸ ਵਿੱਚ ਉਹਨਾਂ ਦੇ ਸ਼ਬਦਾਂ ਵਿੱਚ ਉਹਨਾਂ ਦਾ ਇੱਕ ਕੋਟ ਹੈ ਜਿਸਦਾ ਹੈ ਮੈਂ ਰਾਹਾਂ 'ਤੇ ਨਹੀਂ ਤੁਰਦਾ ਜਦ ਤੁਰਦਾ ਹਾਂ ਤਾਂ ਰਾਹ ਬਣਦੇ ਹਨ ਉਹਨਾਂ ਦੇ ਇਸ ਤਰ੍ਹਾਂ ਦੇ ਕਾਫੀ ਜੋ ਛੋਟੇ ਛੋਟੇ ਕੋਟਸ ਹਨ ਉਹ ਬਹੁਤ ਜ਼ਿਆਦਾ ਮੋਟੀਵੇਸ਼ਨ ਦੇਣ ਵਾਲੇ ਹਨ ਇਸ ਲਈ ਮੇਰੇ ਪ੍ਰਸਿੱਧ ਮੇਰੇ ਮ ਪਸੰਦੀਦਾ ਲੇਖਕ ਸੁਰਜੀਤ ਪਾਤਰ ਹਨ